ਸਾਡੇ ਇਲਾਕੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਨੇ ਤਰ੍ਹਾਂ ਦੇ ਬੈਂਕਾਂ ਦੀ ਸਹੂਲਤਾਂ ਹਨ ਜਿਵੇਂ ਕਿ ਪ੍ਰਾਈਵੇਟ ਬੈਂਕਾਂ ਦੇ ਵਿੱਚ ਐੱਚ ਡੀ ਐੱਫ ਸੀ ਆਈ ਡੀ ਐੱਫ ਸੀ ਆਈ ਸੀ ਆਈ ਸੀ ਬੈਂਕ ਬੈਂਕ ਉਪਲਬਧ ਹਨ ਪਰ ਅਸੀਂ ਜਿਆਦਾਤਰ ਪ੍ਰਾਈਵੇਟ ਬੈਂਕਾਂ ਨਾਲੋਂ ਜਿਆਦਾ ਅਸੀਂ ਸਰਕਾਰੀ ਬੈਂਕਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਓਥੇ ਓਥੇ ਸਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਵੀ ਜਾਂਦਾ ਹੈ ਅਤੇ ਵਧੀਆ ਸਹੂਲਤਾਂ ਵੀ ਦਿੱਤੀਆਂ ਦਿੰਦੀਆਂ ਹਨ ਅਤੇ ਰਹੀ ਗੱਲ ਲੋਨਸ ਵਗੈਰਾ ਦੀ ਕਰਜੇ ਦੀ ਉਹ ਵੀ ਸਾਨੂੰ ਸਹੀ ਤਰੀਕੇ ਨਾਲ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ ਅਤੇ ਪ੍ਰਾਈਵੇਟ ਬੈਂਕਾਂ ਦੀ ਸਭ ਤੋਂ ਜੋ ਗਲਤ ਗੱਲ ਇਹ ਲੱਗਦੀ ਹੈ ਕਿਉਂਕਿ ਓਥੇ ਤੁਹਾਡੇ ਅਤੇ ਤੁਹਾਡੇ ਅਕਾਊਂਟ 'ਤੇ ਵੱਧ ਤੋਂ ਵੱਧ ਚਾਰਜਸ ਲਗਾ ਕੇ ਤੁਹਾਡੇ ਅਕਾਊਂਟ ਵਿੱਚੋਂ ਉਹ ਵੱਧ ਤੋਂ ਵੱਧ ਪੈਸੇ ਕੱਟ ਮਤਲਬ ਪੈਸੇ ਕੱਟ ਲਏ ਜਾਂਦੇ ਹਨ ਇਸ ਕਰਕੇ ਅਸੀਂ ਜਿਆਦਾਤਰ ਸਰਕਾਰੀ ਬੈਂਕਾਂ ਨੂੰ ਹੀ ਤਰਜੀਹ ਦਿੰਦੇ ਹਨ